ਵੈਸੇ ਤਾਂ ਪੰਜਾਬ ਦੇ ਵਿੱਚ ਕਾਫ਼ੀ ਐਸੇ ਹੈਗੇ ਹੈ ਜਿਹੜੇ ਸੈਲਾਨੀਆਂ ਵਾਸਤੇ ਆਕਰਸ਼ਣ ਦਾ ਕੇਂਦਰ ਹਨ ਪਰ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਇਸ ਲਈ ਏ ਮੈਨੂੰ ਅੰਮ੍ਰਿਤਸਰ ਦੇ ਜਿਹੜੇ ਖਾਸ ਆਕਰਸ਼ਣ ਦਾ ਕੇਂਦਰ ਹਨ ਜਿੱਥੇ ਸੈਲਾਨੀ ਆਉਂਦੇ ਹਨ ਉਹ ਉਹਨਾਂ ਵਿੱਚੋਂ ਜਲਿਆਂਵਾਲਾ ਬਾਗ ਇੱਕ ਮੇਨ ਜਿਹੜਾ ਮੁੱਖ ਆਕਰਸ਼ਣ ਦਾ ਕੇਂਦਰ ਹੈਗਾ ਹੈ ਇੱਥੇ ਜਲਿਆਂਵਾਲੇ ਬਾਗ 'ਚ ਜਦੋਂ ਭਾਰਤ ਆਜ਼ਾਦ ਹੋਣ ਤੋਂ ਪਹਿਲੇ ਇੱਥੇ ਜਨਰਲ ਡਾਇਰ ਨੇ ਵਿਸਾਖੀ ਵਾਲੇ ਦਿਨ ਇੱਥੇ ਗੋਲੀਆਂ ਚਲਾਈਆਂ ਸਨ ਅਤੇ ਅੱਜ ਉਹ ਇੱਕ ਮਿਊਜ਼ੀਅਮ ਦੇ ਰੂਪ ਦੇ ਵਿੱਚ ਉੱਥੇ ਬਣਾ ਦਿੱਤਾ ਗਿਆ ਹੈ ਉਹਦੀ ਯਾਦ ਵਿੱਚ ਬਣ ਗਿਆ ਹੈ ਜਲਿਆਂਵਾਲਾ ਬਾਗ ਦਾ ਜਿਹੜਾ ਹੈ ਉਹ ਮਿਊਜ਼ਅਮ ਹੈ ਉੱਥੇ ਲੋਕ ਜਾਂਦੇ ਹਨ ਅਤੇ ਉੱਥੇ ਆਪਣਾ ਸੈਲਾਨੀ ਜਿਹੜੇ ਬਾਹਰੋਂ ਆਉਂਦੇ ਹਨ ਉਹ ਉੱਥੇ ਜਾ ਕੇ ਉਸਨੂੰ ਦੇਖਦੇ ਹਨ ਵੈਸੇ ਤਾਂ ਉਹ ਹੋਰ ਵੀ ਹਨ ਇੱਥੇ ਵਾਹਗਾ ਬੋਡਰ ਪੈਂਦਾ ਹੈ ਯਾਨੀ ਅਟਾਰੀ ਦੇ ਕੋਲ ਭਾਰਤ ਪਾਕਿਸਤਾਨ ਦਾ ਬੋਡਰ ਹੈ ਉੱਥੇ ਵੀ ਸੈਲਾਨੀ ਬਹੁਤ ਜਾਂਦੇ ਹਨ ਅਤੇ ਸ਼ਾਮ ਨੂੰ ਉਥੋਂ ਉੱਥੇ ਜਾ ਕੇ ਜਿਹੜੀ ਕਿ ਆਪਣਾ ਸੈਨਾ ਵੱਲੋਂ ਉੱਥੇ ਪਰੇਡ ਕੀਤੀ ਜਾਂਦੀ ਹੈ ਉਸ ਨੂੰ ਦੇਖਦੇ ਹਨ ਅਤੇ ਕਈ ਵਾਰੀ ਉੱਥੇ ਉਸ ਪਰੇਡ ਤੋਂ ਹੋਣ ਤੋਂ ਪਹਿਲੇ ਕੁਛ ਰੰਗਾਰੰਗ ਕਾਰਿਆਕ੍ਰਮ ਵੀ ਹੁੰਦੇ ਹਨ ਜਿਹੜੇ ਲ ਉਥੋਂ ਦੇ ਮਿਲਟਰੀ ਵਾਲਿਆਂ ਨੇ ਆਪਣੇ ਫੌਜੀਆਂ ਨੇ ਰੱਖੇ ਹੁੰਦੇ ਹਨ ਪ੍ਰੋਗਰਾਮ ਉਹਨਾਂ 'ਚ ਹਿੱਸਾ ਲੈਂਦੇ ਹਨ ਲੋਕ ਅਤੇ ਉਹਨਾਂ ਨੂੰ ਦੇਖਦੇ ਹਨ ਅਤੇ ਉੱਦਾਂ ਪੰਜਾਬ ਦੇ ਵਿੱਚ ਹੋਰ ਵੀ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹਨ ਉਹ ਹੈਗਾ ਹੈ ਇੱਕ ਬਹਾਦਰਗੜ ਫੋਰਟ ਇੱਕ ਹੈਗਾ ਹੈ ਫਿਲੌਰ ਦਾ ਫੋਰਟ ਅਤੇ ਇੱਕ ਹੈਗਾ ਵਾ ਜਲੰਧਰ ਦੇ ਵਿੱਚ ਸਾਇੰਸ ਸਿਟੀ ਬਣੀ ਹੋਈ ਹੈ ਉਹ ਵੀ ਦੇਖਣ ਜਾਂਦੇ ਹਨ ਇਸ ਅਤੇ ਮੇਨ ਜਿਹੜਾ ਹੈਗਾ ਹੈ ਉਹ ਅਸੀਂ ਮੈਂ ਤਾਂ ਅੰਮ੍ਰਿਤਸਰ ਦੇ ਹੀ ਜਿਹੜੇ ਦੇਖੇ ਹਨ ਉਹ ਹੀ ਦੇਖਦਾ ਅਤੇ ਮੈਂ ਅੰਮ੍ਰਿਤਸਰ ਦੇ ਵਿੱਚ ਸੈਲਾਨੀਆਂ ਵਾਸਤੇ ਵੈਸੇ ਤਾਂ ਉਹ ਸ਼ਰਧਾਲੂਆਂ ਵਾਸਤੇ ਹੈ ਗੋਲਡਨ ਟੈਂਪਲ ਲੇਕਿਨ ਉੱਥੇ ਸੈਲਾਨੀ ਵੀ ਕਈ ਆਉਂਦੇ ਹਨ ਇਹ ਇੱਕ ਧਰਮ ਦੇ ਨਾਲ ਰਿਲੇਟਿਡ ਇੱਕ ਬਹੁਤ ਹੀ ਅੱਛਾ ਅਤੇ ਸੁਲਾਤੋਹਾਵਣਾ ਉੱਥੇ ਜਾ ਕੇ ਆਨੰਦ ਮਾਣਦੇ ਹਨ ਕੀਰਤਨ ਸੁਣ ਕੇ ਆਪਣੇ